ਇੱਕ ਲੱਖ ਪਚਾਨਵੇਂ ਹਜ਼ਾਰ ਨੌ ਸੌ ਛੱਤੀ ਪੰਜ ਲੱਖ ਤੇਤੀ ਹਜ਼ਾਰ ਤਿੰਨ ਸੌ ਤੇਤੀ ਛੇ ਲੱਖ ਇਕਤਾਲੀ ਹਜ਼ਾਰ ਸੱਤ ਲੱਖ ਉਣੰਜਾ ਹਜ਼ਾਰ ਪੰਜ ਸੌ ਪੰਜਾਹ ਅੱਠ ਲੱਖ ਨੌ ਸੌ ਪੰਜਾਹ